ਇੱਕ ਲੱਖ ਗਿਆਰ੍ਹਾਂ ਹਜ਼ਾਰ ਪੰਜ ਸੌ ਚੁਰੰਜਾ ਦੋ ਲੱਖ ਪੱਚੀ ਹਜ਼ਾਰ ਪੰਜ ਸੌ ਬੱਤੀ ਤਿੰਨ ਲੱਖ ਚੌਂਹਠ ਹਜ਼ਾਰ ਅੱਠ ਸੌ ਇਕਿਆਸੀ ਤਿੰਨ ਲੱਖ ਚੌਂਤੀ ਹਜ਼ਾਰ ਚਾਰ ਲੱਖ ਪੰਜ ਹਜ਼ਾਰ ਪੰਜ ਸੌ ਬੱਤੀ